ਸਤਿ ਸ਼੍ਰੀ ਅਕਾਲ ਜੀ ਬਸ ਵਧੀਆ ਜੀ ਵਧੀਆ ਹੋਰ ਤੁਸੀਂ ਸੁਣਾਓ ਘਰ ਪਰਿਵਾਰ ਸਭ ਵਧੀਆ ਬਸ ਆਪਾਂ ਹੀ ਲਿਖਾਈ ਕਰਦੇ ਹਾਂ ਜੀ ਹੋਰ ਤੁਸੀਂ ਦੱਸੋ ਤੁਸੀਂ ਵੀ ਲਿਖਾਈ ਕਰਦੇ ਹੋ ਜੀ ਠੀਕ ਹੈ ਤੁਸੀਂ ਕਿਵੇਂ ਲਿਖਾਈ ਕਰਦੇ ਹੋ ਠੀਕ ਹੈ ਜੀ ਠੀਕ ਹੈ ਅੱਛਾ ਜੀ ਤੁਸੀਂ ਆਪਣਾ ਲਿਖਾਈ ਨੂੰ ਪੇਪਰ 'ਤੇ ਵੀ ਉਤਾਰਦੇ ਹੋ ਜੀ ਅੱਛਾ ਜੀ ਠੀਕ ਕਿਹੜੇ ਕਿਹੜੇ ਵਿਸ਼ਿਆਂ 'ਤੇ ਤੁਸੀਂ ਲਿਖ ਅੱਛਾ

ਅੱਛਾ ਜੀ ਤੁਹਾਨੂੰ ਠੀਕ ਹੈ ਤੁਹਾਨੂੰ ਇਹ ਅੱਜ ਕੱਲ੍ਹ ਲਿਖਣ ਦੇ ਵਿੱਚ ਕੋਈ ਮੁਸ਼ਕਲ ਦਾ ਕਦੀ ਸਾਹਮਣਾ ਕਰਨਾ ਪਿਆ ਜੀ ਠੀਕ ਹੈ ਅਤੇ ਤੁਸੀਂ ਇਸ ਲਿਖਾਈ ਦੇ ਲਈ ਮੈਨੂੰ ਕੁਝ ਸੁਝਾਅ ਦੇਣਾ ਚਾਹੋਗੇ ਅੱਛਾ ਜੀ ਅੱਛਾ ਜੀ ਤੁਸੀਂ ਕਿਵੇਂ ਆਪਣੇ ਲਿਖਾਈ ਦੇ ਵਿਸ਼ੇ ਨੂੰ ਚੁਣਦੇ ਹੋ ਠੀਕ ਹੈ ਜੀ ਤੁਸੀਂ ਕਿਵੇਂ ਆਪਣੇ ਲਿਖਾਈ ਦੇ ਵਿਸ਼ੇ ਨੂੰ ਵਿਕਸਿਤ ਕਰਦੇ ਹੋ ਅੱਛਾ ਜੀ ਆਪਣਾ ਆਲਾ ਦੁਆਲਾ ਜਿਵੇਂ ਵਾਤਾਵਰਨ ਦਾ ਕਹਿ ਰਹੇ ਹੋ ਕਿ ਉਹਦੇ ਵਿੱਚ ਕੀ ਕੀ ਹੋ ਰਿਹਾ ਕੀ ਆ ਰਿਹਾ ਜੀ ਉਹ ਤੁਸੀਂ ਹਰ ਪ੍ਰਗਟ ਕਰਦੇ ਦੇ

ਅੱਛਾ ਜੀ ਅੱਛਾ ਜੀ ਉਹਨੂੰ ਵੇਖ ਕੇ ਤੁਹਾਡੇ ਮਨ 'ਚ ਵਿਚਾਰ ਆ ਜਾਂਦੇ ਵਿਚਾਰ ਆਪਣੇ ਆਪ ਪ੍ਰਗਟ ਹੋ ਜਾਂਦੇ ਨੇ ਅੱਛਾ ਕਿਵੇਂ ਉਹਨਾਂ ਦਾ ਸੁੰਦਰੀਕਰਨ ਕਰਨਾ ਜੀ

ਅੱਛਾ ਜੀ ਇਹ ਤਾਂ ਫਿਰ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਫਿਰ ਹੈ ਨਾ ਜੀ

ਹਾਂਜੀ ਹਾਂਜੀ ਅਤੇ ਤੁਸੀਂ ਕਿਵੇਂ ਆਪਣੀ ਲਿਖਾਈ ਨੂੰ ਪ੍ਰਕਾਸ਼ਿਤ ਕਰਦੇ ਹੋ ਅੱਛਾ ਜੀ ਅੱਛਾ ਜੀ ਠੀਕ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਹਾਂ ਇੱਕ ਦੋ ਵਾਰ ਦੇਖਿਆ ਸੀ ਮੈਂ ਪੜ੍ਹੀ ਸੀ ਅਖ਼ਬਾਰ ਇੱਕ ਦੋ ਵਾਰ ਤੁਹਾਡਾ ਨਾਮ ਆਇਆ ਸੀ ਇਹਦੇ ਵਿੱਚ ਅਤੇ ਤੁਸੀਂ ਕਿਤਾਬਾਂ ਵੀ ਲਿਖਦੇ ਹੋ ਜੀ ਉਹ ਉਮਰਾਂ ਦੇ ਹਿਸਾਬ ਨਾਲ ਫਿਰ ਤੁਸੀਂ ਉਮਰਾਂ ਜਵਾਨੀ ਢਲਦੀ ਜਾਂਦੀ ਕਹਿੰਦੇ ਕਿ ਵਿਚਾਰ ਚੰਗੇ ਹੁਣ ਆਉਂਦੇ ਨਹੀਂ ਤੁਹਾਡੇ ਦਿਮਾਗ 'ਚ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ

ਹਾਂਜੀ ਹਾਂਜੀ ਠੀਕ ਹੈ ਜੀ ਓਕੇ ਠੀਕ ਹੈ ਜੀ ਆਪਣਾ ਸਮਾਂ ਹੋ ਗਿਆ ਠੀਕ ਹੈ ਧੰਨਵਾਦ